ਬੈਂਕਿੰਗ ਅਤੇ ਬੀਮਾ ਸਾਡੇ ਭਵਿੱਖ ਲਈ ਬਹੁਤ ਹੀ ਵਧੀਆ ਅਧਿਕਾਰ ਜਾਂ ਯੋਜਨਾਵਾਂ ਲੈ ਕੇ ਆਇਆ ਹੈ ਬੈਂਕ ਦੇ ਵਿੱਚ ਪੈਸੇ ਰੱਖ ਕੇ ਸਾਨੂੰ ਉਹਦਾ ਮੁਨਾਫਾ ਮਿਲਦਾ ਹੈ ਜਦੋਂ ਕਿ ਘਰ ਵਿੱਚ ਰੱਖੇ ਪੈਸੇ ਦਾ ਸਾਨੂੰ ਕੋਈ ਮੁਨਾਫਾ ਨਹੀਂ ਮਿਲਦਾ ਬੈਂਕ ਵਿੱਚ ਰੱਖ ਕੇ ਸਾਡੇ ਪੈਸੇ ਸ ਮ ਮਹਿਫੂਜ ਰਹਿੰਦੇ ਹਨ ਜਦੋਂ ਕਿ ਘਰ ਵਿੱਚ ਸਾਡਾ ਪੈਸਾ ਮ ਮਹਿਫੂਜ਼ ਨਹੀਂ ਰਹਿੰਦਾ ਬੀਮਾ ਯੋਜਨਾਵਾਂ ਨੇ ਤਾਂ ਬਹੁਤ ਹੀ ਵਧੀਆ ਕਾਰਗਾਰ ਸਕੀਮਾਂ ਕੱਢੀਆਂ ਹਨ ਜਿਹਦੇ ਜਿਹਦੇ ਨਾਲ ਕਿ ਜੇ ਜੇ ਕਿਸੇ ਵਿਅਕਤੀ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਲਈ ਵੀ ਬੜੀ ਸਹਾਈ ਹੁੰਦਾ ਹੈ ਇਹ ਸਾਡੇ ਸਿਹਤ ਵਾਸਤੇ ਵੀ ਸਿਹਤ ਬੀ ਸਿਹਤ ਬੀਮਾ ਵਿੱਦਿਆ ਲਈ ਬੀਮਾ ਅਤੇ ਹੋਰ ਕਈ ਬੀਮਿਆਂ ਦੇ ਨਾਲ ਅਸੀਂ ਇਹਨਾਂ ਦਾ ਫਾਇਦਾ ਉਠਾ ਸਕਦੇ ਹਾਂ ਸਿਹਤ ਬੀਮਾ ਤਾਂ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਤੁਸੀਂ ਆਪਣੀ ਸਿਹਤ ਲਈ ਬੀਮਾ ਕਰਵਾ ਕੇ ਜੇ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਇਸਦੇ ਪੈਸੇ ਤੁਹਾਨੂੰ ਖੁਦ ਨਹੀਂ ਖਰਚਣੇ ਪੈਂਦੇ ਉਹ ਤੁਹਾਨੂੰ ਸਰਕਾਰ ਵੱਲੋਂ ਮਿਲ ਜਾਂਦੇ ਨੇ ਇਹ ਜਿਹੜੀਆਂ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਉਹ ਸਾਡੇ ਲਈ ਬਹੁਤ ਹੀ ਕਾਰਗਾਰ ਸਿੱਧ ਹੋ ਰਹੀਆਂ ਹਨ